ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਅਸੀਂ ਲੁਧਿਆਣਾ ਤੋਂ ਬੋਲ ਰਹੇ ਸੀ ਮੈਮ ਅਸੀਂ ਇੱਕ ਪਾਰਸਲ ਮੰਗਵਾਇਆ ਸੀ ਹਫ਼ਤਾ ਪਹਿਲਾਂ ਅਤੇ ਮੈਮ ਉਹ ਪਾਰਸਲ ਡਿਫੈਕਟਿਵ ਆ ਗਿਆ ਹਾਂਜੀ ਜੀ ਥੋੜ੍ਹਾ ਮਤਲਬ ਕਲਰ ਚੇਂਜ ਆ ਗਿਆ ਸੀ ਮਤਲਬ ਪਰਪਲ ਕਿਹਾ ਸੀ ਅਤੇ ਲਾਈਟ ਪੀਚ ਸ਼ੇਡ ਆ ਗਿਆ ਅਤੇ ਅਸੀਂ ਉਹਨੂੰ ਰਿਟਰਨ ਕਰਨਾ ਚਾਹੁੰਦੇ ਸੀ ਨਹੀਂ ਮੈਮ ਜੇ ਮੰਨ ਲਓ ਹੁਣ ਅਸੀਂ ਜਿਹੜਾ ਕਲਰ ਕੀਤਾ ਸੀ ਉਹ ਆਇਆ ਨਹੀਂ ਚੇਂਜ ਆਇਆ ਡਿਫੈ ਡਿਫੈਕਟਿਵ ਹੀ ਹੋਇਆ ਮਤਲਬ ਸਾਨੂੰ ਵਧੀਆ ਨਹੀਂ ਲੱਗਿਆ ਪਾਰਸਲ ਨਹੀਂ ਮੈਮ ਵੀਡੀਓ ਤਾਂ ਨਹੀਂ ਬਣਾਈ

ਹਾਂਜੀ ਹਾਂਜੀ ਮੈਮ ਮੈਮ ਫੋਟੋ ਵੀ ਤਾਂ ਪਾ ਸਕਦੇ ਹਾਂ ਅਗਰ ਹੁਣ ਫੋਟੋ ਪਾ ਦੇਦੀਏ ਤਾਂ ਹਾਂਜੀ ਪਰ ਵੈਸੇ ਮੈਮ ਅਸੀਂ ਰਿਟਰਨ ਹੀ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਵਧੀਆ ਨਹੀਂ ਲੱਗਿਆ ਪਾਰਸਲ ਪੇਮੈਂਟ ਕੈਸ਼ ਅੋਨ ਡਲਿਵਰੀ ਹਾਂਜੀ ਹਾਂਜੀ ਓਕੇ ਮੈਮ